ਹੈਲੋ ਹੈ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਅਸੀਂ ਸੰਧੂ ਸਕੂਲ ਤੋਂ ਗੱਲ ਕਰ ਰਹੇ ਹਾਂ ਸਰ ਅੱਜ ਨਾ ਬੱਚਿਆਂ ਨੂੰ ਜਲਦੀ ਛੁੱਟੀ ਹੋ ਗਈ ਹੈ ਅਤੇ ਤੁਸੀਂ ਲੈ ਲੈ ਸਕਦੇ ਹੋ ਸਰ ਐਕਚੁਅਲੀ ਅੱਜ ਫੰਕਸ਼ਨ ਹੈ ਸੀਗਾ ਸਕੂਲ ਵਿੱਚ ਅਤੇ ਡਾਇਰੀ 'ਚ ਦਿੱਤਾ ਸੀਗਾ ਨੋਟ ਵੈਸੇ ਕਿ ਅੱਜ ਜਲਦੀ ਛੁੱਟੀ ਹੋਊਗੀ ਅਤੇ ਇਕੋ ਦਮ ਅਸੀਂ ਥੋੜ੍ਹੀ ਓ ਟਾਈਮ ਤੋਂ ਪਹਿਲਾਂ ਛੁੱਟੀ ਕਰਨੀ ਪੈ ਗਈ ਸਰ ਤੁਸੀਂ ਫਿਰ ਕਿਸੇ ਹੋਰ ਨੂੰ ਨਹੀਂ ਭੇਜ ਸਕਦੇ ਜਾਂ ਜਿੱਦਾਂ ਸਰ ਆਈ ਡੀ ਕਾਰਡ 'ਤੇ ਜੋ ਵੀ ਹੈਗੇ ਕਿਸੇ ਪੇਰੈਂਟਸ ਉਹਨਾਂ ਦੀ ਫੋਟੋ ਉਹਨਾਂ ਨੂੰ ਭੇਜ ਦਿਓ ਜਾਂ ਫਿਰ ਓਕੇ ਹਾਂਜੀ ਹਾ ਫਿਰ ਸਰ ਮੈਂ ਤੁਹਾਨੂੰ ਨਾ ਇੱਕ ਕੰਸੈਂਡ ਲੈਟਰ ਕਰ ਦੂੰਗੀ ਸੈਂਡ ਅਤੇ ਜਿਹੜਾ ਕੋਈ ਲੈਣ ਆਉਗਾ ਨਾ ਤਾਂ ਤੁਸੀਂ ਉਹਨਾਂ ਦਾ ਆਈ ਡੀ ਪਰੂਫ ਨਾਲ ਭੇਜ ਦਿਓ ਅਤੇ ਉਹਨਾਂ ਦੇ ਸਾਈਨ ਹੋਣੇ ਚਾਹੀਦੇ ਨੇ ਹਾਂਜੀ ਕਿਉਂਕਿ ਉਹਨਾਂ ਦੇ ਜਿਹੜੇ ਹਾਂਜ ਹਾਂਜੀ ਹਾਂਜੀ ਮੈਂ ਤੁਹਾਨੂੰ ਸੈਂਡ ਕਰ ਦੂੰਗੀ ਨਾ ਤੁਸੀਂ ਉਹ ਪ੍ਰਿੰਟ ਆਊਟ ਕਢਵਾ ਕੇ ਫਿਰ ਉਹਦੇ 'ਤੇ ਨਾਮ ਉਹਨਾਂ ਦਾ ਤੁਹਾਡੇ ਵੀ ਸਾਈਨ ਹੋਣੇ ਚਾਹੀਦੇ ਤੁਸੀਂ ਭੇਜ ਰਹੇ ਹੋ ਨਾ ਉਹਨਾਂ ਨੂੰ ਆਪਣੇ ਉਹਦੇ 'ਤੇ ਅਤੇ ਉਹਨਾਂ ਦਾ ਆਈ ਡੀ ਪਰੂਫ ਹੋਣਾ ਚਾਹੀਦਾ ਨਾਲ ਸ ਪੰਦਰਾਂ ਕੁ ਮਿੰਟ ਤੱਕ ਭੇਜ ਦਾਂਗੇ ਸਰ ਮੈਂ ਤੁਹਾਨੂੰ ਅਤੇ ਤੁਸੀਂ ਫਿਲ ਕਰਕੇ ਉਹ ਫੋਮ 'ਤੇ ਤੁਸੀਂ ਫਿਰ ਉਹਨਾਂ ਨੂੰ ਭੇਜ ਦਿਓ ਲੈਣ ਆ ਜਾਣਗੇ ਨਹੀਂ ਨਹੀਂ ਸਰ ਉੱਧਰ ਤਾਂ ਪੇਰੈਂਟਸ ਹੀ ਅ ਲੈ ਕੇ ਜਾਂਦੇ ਨੇ ਛੋਟੇ ਬੱਚਿਆਂ ਲਈ ਤਾਂ ਕੋਈ ਵੈਨ ਦੀ ਹੈ ਨਹੀਂ ਨਾ ਸਰ ਘੰਟੇ ਤੱਕ ਫਰੀ ਓਪਨ ਨੇ ਸਰ ਤੁਸੀਂ ਆ ਜਾਇਓ ਹਾਂਜੀ ਓਕੇ ਸਰ